ਸਿਲਾਈ ਅਤੇ ਬੁਣਾਈ ਲਈ ਮੈਂ ਰੰਗਾਂ ਦੀ ਚੋਣ ਆਪਣੇ ਸੀਨੀਅਰ ਤੋਂ ਕਰ ਲੈਦੀ ਹਾਂ ਜਿਸ ਤਰ੍ਹਾਂ ਮੈਂ ਸਿਲਾਈ ਕਰਨੀ ਹੁੰਦੀ ਅਤੇ ਮੈਂ ਬੁਟੀਕ ਆਪਣਾ ਖੋਲ੍ਹਿਆ ਹੋਇਆ ਬੁਟੀਕ 'ਤੇ ਆਪਣੇ ਟੇਲਰ ਕੋਲੋਂ ਸਲਾਹ ਲੈ ਲੈਂਦੀ ਹਾਂ ਜਾਂ ਫਿਰ ਮਾਰਕੀਟ 'ਚ ਜਾ ਕੇ ਦੇਖ ਲੈਂਦੀ ਹਾਂ ਕਿ ਕੀ ਚੱਲ ਰਿਹਾ ਕੀ ਨਹੀਂ ਚੱਲ ਰਿਹਾ ਜਿਸ ਤਰ੍ਹਾਂ ਦੀ ਕਲਰ ਡਿਮਾਂਡ 'ਚ ਆ ਹੈ ਉਸ ਤਰ੍ਹਾਂ ਦਾ ਮਤਲਵ ਕਿ ਲੈ ਆਈਦੇ ਆ ਅਤੇ ਬਾਕੀ ਆਪ ਵੀ ਕੁਛ ਕਸਟਮਰ ਵੀ ਸਲਾਹ ਦੇ ਦਿੰਦੇ ਆ ਕਿ ਤੁਸੀਂ ਐਹ ਵਾਲਾ ਲੈ ਲੋ ਐਹ ਵਾਲਾ ਕਰ ਲੋ ਅੱਜ ਇਹ ਟਰੈਂਡ ਆ ਜਾਂ ਫਿਰ ਗੂਗਲ ਸਰਚ ਮਾਰ ਲਈ ਦੀ ਆ ਯੂਟੀਊਬ ਦੇ ਉੱਤੇ ਅੱਜ ਕੱਲ੍ਹ ਕਾਫੀ ਦੱਸ ਦਿੰਦੇ ਆ ਬਾਕੀ ਜਿੱਥੇ ਬਾਕੀ ਰੰਗਾਂ ਦੀ ਗੱਲ ਕਰੋ ਜਿਸ ਤਰ੍ਹਾਂ ਸਿਲਾਈ ਅ ਕਰੋਸ਼ ਅ ਉੱਨ ਵਗੈਰਾ ਦੀ ਮੰਦਿਰ ਵਿੱਚ ਜਿਸ ਤਰ੍ਹਾਂ ਹੁੰਦੇ ਆ ਉਹ ਕਹਿ ਦਿੰਦੇ ਕਿ ਇਸ ਕਲਰ ਦੀ ਡਰੈਸ ਕਰਨੀ ਆ ਤਿਆਰ ਇਹ ਵਾਲਾ ਕਲਰ ਤੁਸੀਂ ਲੈ ਲਿਉ ਅੱਜ ਕੱਲ੍ਹ ਜਿਸ ਤਰ੍ਹਾਂ ਮੰਨ ਲਿਉ ਕਿ ਜਿਸ ਤਰ੍ਹਾਂ ਕੋਈ ਜਨਮਅਸ਼ਟਮੀ ਆਉਣ ਵਾਲੀ ਹੈ ਅਤੇ ਇਹ ਵਾਲਾ ਕਲਰ ਠਾਕੁਰ ਜੀ ਨੂੰ ਸਾਰਿਆਂ ਨੇ ਪਾਉਣਾ ਅਤੇ ਜਾਂ ਫਿਰ ਆਹ ਬਸੰਤ ਆਉਣ ਵਾਲੀ ਤਾਂ ਅੱਜ ਕੱਲ੍ਹ ਹੁਣ ਯੈਲੋ ਕਲਰ ਦੀ ਹੈ ਡਰੈਸ ਡਰੈਸਿਜ਼ ਵਗੈਰਾ ਤਿਆਰ ਹੋ ਰਹੀਆਂ ਠਾਕੁਰ ਜੀ ਦੀਆਂ ਜੀ ਬਸ ਬਾਕੀ ਮਨਪਸੰਦ ਰੰਗ ਦੀ ਗੱਲ ਕਰੋ ਅਤੇ ਮੇਰਾ ਮਨਪਸੰਦ ਰੰਗ ਬਲਿਊ ਵੈਸੇ ਤਾਂ ਤਿੰਨ ਚਾਰ ਕਲਰ ਅੱਛੇ ਲੱਗਦੇ ਮੈਨੂੰ ਜਿਸ ਤਰ੍ਹਾਂ ਯੈਲੋ ਹੋ ਗਿਆ ਬਲਿਊ ਹੋ ਗਿਆ ਬਲੈਕ ਔਰ ਪਰਪਲ ਲੇਕਿਨ ਮੈਨੂੰ ਜ ਮੇਰਾ ਮਨਪਸੰਦ ਬਲਿਊ ਔਰ ਬਲੈਕ